ਸਾਡੇ ਇਲਾਕੇ ਵਿੱਚ ਪੰ ਜਿਵੇਂ ਪੰਜਾਬ ਵਿੱਚ ਵੱਖ ਵੱਖ ਤਰ੍ਹਾਂ ਮੌਸਮਾਂ ਵਿੱਚ ਵੱਖ ਵੱਖ ਤਰ੍ਹਾਂ ਦੀ ਫਸਲਾਂ ਪੈ ਫਸਲਾਂ ਪੈਦਾ ਹੁੰਦੀਆਂ ਹਨ ਜਿਵੇਂ ਕਿ ਜੀਰੀ ਕਣਕ ਸਰ੍ਹੋਂ ਆਦਿ ਪਰ ਇਹ ਵੀ ਮੌਸਮ ਅਨੁਸਾਰ ਹੁੰਦੇ ਹਨ ਜਿਵੇਂ ਸਰਦੀਆਂ ਸ਼ੁਰੂ ਹੋਣ 'ਤੇ ਅਸੀਂ ਕਣਕ ਬੀਜਦੇ ਹਾਂ ਅਤੇ ਉਹ ਜਿਹੜੀ ਕਣਕ ਦੀ ਕਟਾਈ ਹੈ ਉਹ ਅਪ੍ਰੈਲ ਵਿੱਚ ਜਾ ਕੇ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਅਪ੍ਰੈਲ ਜਦੋਂ ਅਪ੍ਰੈਲ ਸਾਰਾ ਲੰਘ ਜਾਂਦਾ ਹੈ ਕਿਉਂਕਿ ਉਹ ਤਾਂ ਕਟਾਈ ਵਿੱਚ ਹੀ ਲੰਘ ਜਾਂਦਾ ਉਸ ਤੋਂ ਬਾਅਦ ਜਿਹੜਾ ਅਗਲਾ ਮਹੀਨਾ ਹੁੰਦਾ ਹੈ ਉਸ 'ਚ ਅਸੀਂ ਜੀਰੀ ਬੀਜਦੇ ਹਾਂ ਫਿਰ ਉਹ ਅਗਸਤ ਵਿੱਚ ਕੱਟੀ ਜਾਂਦੀ ਹੈ ਇਸ ਤਰ੍ਹਾਂ ਹੀ ਇਹ ਚੱਲਦਾ ਰਹਿੰਦਾ ਹੈ ਫਿਰ ਜਦੋਂ ਇਹ ਆਪਣਾ ਸਰਦੀਆਂ ਦਾ ਸੈਪਤੰਬਰ ਦਾ ਮਹੀਨਾ ਸ਼ੁਰੂ ਸੈਪਤੰਬਰ ਅਕਤੂਬਰ ਦਾ ਫਿਰ ਅਸੀਂ ਸਰ੍ਹੋਂ ਦੀ ਖੇਤੀ ਵੀ ਕਰਦੇ ਹਾਂ ਜਿਸਦਾ ਸਰਸੋਂ ਦਾ ਤੇਲ ਵੀ ਬਣਦਾ ਹੈ ਫਿਰ ਅਸੀਂ ਉਹਦੀ ਖੇਤੀ ਕਰਦੇ ਹਾਂ ਬਾਕੀ ਬਾ ਕੁਝ ਲੋਕ ਹਨ ਜਿਹੜੇ ਮੌਸਮ ਅਨੁਸਾਰ ਸਬਜ਼ੀਆਂ ਦੀ ਖੇਤੀ ਵੀ ਕਰਦੇ ਹਨ ਆਲੂਆਂ ਦੀ ਖੇਤੀ ਮਾਂਹ ਦੀ ਦਾਲ ਦੀ ਖੇਤੀ ਛੱਲੀਆਂ ਦੀ ਖੇਤੀ ਵੱਖ ਵੱਖ ਕਿਸਮਾਂ ਦੀ ਖੇਤੀ ਹੁੰਦੀ ਹੈ ਕਿਉਂਕਿ

ਕਣਕ ਕੱਟਣ ਤੋਂ ਲੈ ਕੇ ਜੀਰੀ ਬੀਜਣ ਤੱਕ ਦਾ ਵਿਚਾਲੇ ਮਹੀਨਾ ਹੁੰਦਾ ਹੈ ਉਹ ਖਾਲੀ ਹੀ ਹੁੰਦਾ ਹੈ ਤਾਂ ਉਸ ਵਿੱਚ ਖੇਤ ਖਾਲੀ ਹੀ ਰਹਿੰਦਾ ਹੈ ਉਸ ਖੇਤ ਨੂੰ ਖਾਲੀ ਰਹਿਣ ਤੋਂ ਬਜਾਇ ਉਸ ਵਿੱਚ ਕੋਈ ਸਬਜ਼ੀ ਜਾਂ ਆਲੂ ਕੁਛ ਵੀ ਗਾਜਰ ਬੀਜ ਕੇ ਉਸ ਦਾ ਇਸਤੇਮਾਲ ਕਰ ਲਿਆ ਜਾਂਦਾ ਹੈ ਜਿਸ ਤਰੀਕੇ ਨਾਲ ਉਹਨਾਂ ਨੂੰ ਇੱਕ ਸਬਜ਼ੀਆਂ ਵੀ ਮਿਲ ਜਾਂਦੀਆਂ ਹਨ ਅਤੇ ਜਿਹੜਾ ਉਹਨਾਂ ਦਾ ਖੇਤ ਹੈ ਉਹ ਖਾਲੀ ਵੀ ਨਹੀਂ ਰਹਿੰਦਾ